ਪੰਜਾਬ 'ਚ ਬਹੁਤ ਸਾਰੀਆਂ ਘੁੰਮਣਯੋਗ ਥਾਵਾਂ ਹਨ ਜਿੱਥੇ ਲੋਕ ਬੜੀ ਦੂਰ ਦੂਰ ਤੋਂ ਘੁੰਮਣ ਆਉਂਦੇ ਹਨ ਅੱਜ ਮੈਂ ਤਹਾਨੂੰ ਆਪਣੇ ਪੰਜਾਬ ਬਾਰੇ ਗੱਲ ਕਰਨ ਜਾ ਰਹੀ ਹਾਂ ਜਿੱਥੇ ਕਿ ਘੁੰਮਣਯੋਗ ਥਾਵਾਂ ਹਨ ਸ਼੍ਰੀ ਦਰਬਾਰ ਸਾਹਿਬ ਕਾਠਗੜ੍ਹ ਮੁਕਤੇਸਵਰ ਧਾਮ ਅਤੇ ਸ਼੍ਰੀ ਅਨੰਦਪੁਰ ਸਾਹਿਬ ਅੱਜ ਮੈਂ ਤਹਾਨੂੰ ਕਾਠਗੜ੍ਹ ਬਾਰੇ ਦੱਸਣ ਜਾ ਰਹੀ ਹਾਂ ਜਿੱਥੇ ਲੋਕ ਮਾਰਚ ਮਹੀਨੇ ਜ਼ਿਆਦਾ ਘੁੰਮਣ ਆਉਂਦੇ ਹਨ ਅਤੇ ਉਸ ਸਮੇਂ ਮੌਸਮ ਵੀ ਬਹੁਤ ਵਧੀਆ ਹੁੰਦਾ ਹੈ ਨਾਲੇ ਉਦੋਂ ਸ਼ਿਵਰਾਤਰੀ ਦਾ ਮੇਲਾ ਵੀ ਹੁੰਦਾ ਹੈ ਲੋਕ ਰਾਤ ਨੂੰ ਉੱਥੇ ਰਹਿੰਦੇ ਹਨ ਰਾਤ ਨੂੰ ਰਹਿੰਦੇ ਹਨ ਅਤੇ ਰਾਤ ਨੂੰ ਸ਼ਿਵ ਮਹਾਰਾਜ ਅਤੇ ਪਾਰਵਤੀ ਮਾਤਾ ਦੀ ਮੂਰਤੀ ਇਕੱਠੀ ਹੁੰਦੀ ਹੈ ਅਤੇ ਲੋਕ ਅਰਦਾਸਾਂ ਮੰਗਦੇ ਹਨ ਜੋ ਕਿ ਪੂਰੀਆਂ ਵੀ ਹੁੰਦੀਆਂ ਹਨ ਇੱਥੇ ਘੁੰਮਣ ਦਾ ਸਮਾਂ ਮੇਰੇ ਵੱਲੋਂ ਮਾਰਚ ਜਾਂ ਨਵੰਬਰ ਦਾ ਹੈ ਜਦੋਂ ਬਹੁਤ ਹੀ ਮਜ਼ਾ ਆਉਂਦਾ ਹੈ